ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਅਸੀਂ ਮੁੰਬਈ ਤੋਂ ਪੰਜਾਬ ਘੁੰਮਣ ਵਾਸਤੇ ਆਏ ਹਾਂ ਅਤੇ ਮੇਰੀ ਫਰੈਂਡ ਨੇ ਤੁਹਾਡਾ ਨੰਬਰ ਦਿਆ ਸੀਗਾ ਅਸੀਂ ਤੁਹਾਡੀ ਥੋੜ੍ਹੀ ਹੈਲਪ ਚਾਹੁੰਦੇ ਹਾਂ ਹਾਂ ਤੁਸੀਂ ਸਾਨੂੰ ਦੱਸ ਸਕਦੋ ਹੋ ਕਿ ਪੰਜਾਬ ਦੇ ਵਿੱਚ ਸ਼ੌਪਿੰਗ ਕਰਨ ਵਾਸਤੇ ਵਧੀਆ ਜਗ੍ਹਾ ਕਿਹੜੀਆਂ ਨੇ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ

ਅੱਛਾ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਓਕੇ ਜੀ ਹਾਂਜੀ ਹਾਂਜੀ ਅੱਛਾ ਜੀ ਇਸ ਤੋਂ ਇਲਾਵਾ ਕੋਈ ਹੋਰ ਹਾਂਜੀ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਹੋਰ ਸਰ ਤੁਹਾਡਾ ਧੰਨਵਾਦ ਜੀ ਜਾਣਕਾਰੀ ਲਈ ਹਾਂਜੀ ਥੈਂਕ ਯੂ ਜੀ